ਸਾਡੇ ਖੇਤਰ ਵਿੱਚ ਜੇਕਰ ਕੋਈ ਜਮੀਨ ਖਰੀਦਣ ਜਾਂ ਵੇਚਣਾ ਚਾਹੁੰਦਾ ਹੈ ਤਾਂ ਉਹਦੇ ਅਲੱਗ ਉਹਦੇ ਰਿਗਾਰਡਿੰਗ ਬਹੁਤ ਸਾਰੀਆਂ ਜਿਹੜੀਆਂ ਪ੍ਰੋਬਲਮ ਆ ਉਹਨਾਂ ਦਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਹਿਲਾਂ ਤਾਂ ਇਹ ਹੀ ਗੱਲ ਆ ਜਾਂਦੀ ਹੈ ਕਿ ਜਿਹੜੀ ਟੀਮ ਹੈ ਉਹ ਨਹੀਂ ਪ੍ਰੋਪਰ ਮਿਲਦੀ ਹੈਗੀ ਪਟਵਾਰੀ ਚਾਹੀਦਾ ਹੁੰਦਾ ਆ ਗਿਣਤੀ ਦੀ ਵਪਾਈ ਕਰਨ ਦੇ ਲਈ ਅਤੇ ਉਹ ਤੋਂ ਬਾਅਦ ਤਹਿਸੀਲਦਾਰ ਚਾਹੀਦਾ ਹੁੰਦਾ ਹੈ ਜੇਕਰ ਤਾਂ ਕੋਈ ਮੰਨ ਵੀ ਜਾਂਦੀ ਆ ਮਤਲਬ ਮਿਲ ਵੀ ਜਾਂਦੇ ਆ ਤਾਂ ਹੋਰ ਜਿਹੜੀਆਂ ਫੋਮੈਲਟੀਜ ਆ ਉਹ ਨਹੀਂ ਫੁਲਫਿਲ ਕੀਤੀਆਂ ਜਾਂਦੀਆਂ ਹੈਗੀਆਂ ਕਈ ਵਾਰ ਕੋਈ ਪਾਰਟੀ ਆ ਉਹ ਫਰੋਡੀ ਨਿਕਲਦੀ ਆ ਠੀਕ ਹੈ ਤਾਂ ਕਈ ਵਾਰ ਕੀ ਹੁੰਦਾ ਹੈ ਕਿ ਜਮੀਨ ਜਿਹੜੀ ਹੁੰਦੀ ਆ ਉਹ ਘੱਟ ਵੱਧ ਹੁੰਦੀ ਆ ਜਿੰਨੇ ਕੀ ਫਰਦ ਵਿੱਚ ਨਹੀਂ ਹੁੰਦੀ